ਹੈਲੋ ਮੈਂ ਪਿਛਲੀ ਵਾਰੀ ਸਮਾਨ ਮੰਗਵਾਇਆ ਸੀ ਉਹ ਉਸ ਪਰ ਇੱਕ ਪੱਚੀ ਪ੍ਰਸੈਂਟ ਕੂਪਨ ਮਿਲਿਆ ਮੈਨੂੰ ਅਤੇ ਹੁਣ ਮੈਂ ਅਗਲੇ ਸਮਾਨ ਵਿੱਚ ਮੇਰਾ ਐਡਜਸਟ ਕੀਤਾ ਜਾਵੇ ਜੀ